ਅਸੀਂ ਸੂਟ ਦਾ ਨਾਪ ਲੈਣ ਵਾਸਤੇ ਸਭ ਤੋਂ ਪਹਿਲਾਂ ਸੂਟ ਦੀ ਜਾਂ ਫਿਰ ਜਿਸਦਾ ਨਾਪ ਲੈਣਾ ਹੈ ਉਸਦੀ ਲੰਬਾਈ ਮਾਪਾਂਗੇ ਉਸ ਤੋਂ ਬਾਅਦ ਉਹਨਾਂ ਦਾ ਤੀਰਾ ਉਸ ਤੋਂ ਬਾਅਦ ਉਹਨਾਂ ਦੀ ਬਾਂਹ ਦਾ ਮਾਪ ਫਿਰ ਉਹਨਾਂ ਦੀ ਛਾਤੀ ਦਾ ਮਾਪ ਫਿਰ ਉਹਨਾਂ ਦੇ ਲੱਕ ਦਾ ਮਾਪ ਫਿਰ ਉਹਨਾਂ ਨੇ ਜੋ ਵੀ ਸਲਵਾਣਾ ਹੈ ਜਿਵੇਂ ਕਿ ਅਗਰ ਉਹਨਾਂ ਨੇ ਸਲਵਾਰ ਸ ਸਵਾਣੀ ਹੈ ਅਤੇ ਉਸ ਦਾ ਮਾਪ ਅਤੇ ਅਗਰ ਉਹਨਾਂ ਨੇ ਪਲਾਜ਼ੋ ਜਾਂ ਫਿਰ ਕੋਈ ਅੱਜ ਕੱਲ੍ਹ ਦੇ ਜਿਹੜੇ ਮਾਡਰਨ ਤਰੀਕੇ ਹਨ ਉਹਨਾਂ ਵਿੱਚ ਪੈਂਟ ਚੱਲਦੀ ਹੈ ਖੁੱਲ੍ਹੇ ਵਾਲੇ ਪਲਾਜ਼ੋ ਚੱਲਦੇ ਹਨ ਉਸ ਦੇ ਹਿਸਾਬ ਨਾਲ ਉਹਨਾਂ ਦੀ ਸਲਵਾਰ ਪੈਂਟ ਜਾਂ ਪਲਾਜੋ ਦੀ ਲੰਬਾਈ ਦਾ ਮਾਪ ਉਹਨਾਂ ਦੀ ਬਾਂਹ ਦਾ ਮਾਪ ਉਹਨਾਂ ਦਾ ਗਲਾ ਉਹਦਾ ਮਾਪ ਲਵਾਂਗੇ ਅਸੀਂ ਅਤੇ ਉਹਨਾਂ ਦੀ ਕਮਰ ਦਾ ਮਾਪ ਅਤੇ ਉਸ ਤੋਂ ਬਾਅਦ ਉਹਨਾਂ ਦੀ ਲੱਕ ਲੱਕ ਦਾ ਮਾਪ ਲਵਾਂਗੇ ਉਹਨਾਂ ਦੀ ਲੱਤ ਤੋਂ ਕਿੰਨੀ ਚੌੜਾਈ ਹੈ ਉਸਦਾ ਮਾਪ ਲਵਾਂਗੇ ਇਸ ਤਰ੍ਹਾਂ ਅਸੀਂ ਸੂਟ ਦਾ ਮਾਪ ਲੈ ਸਕਦੇ ਹਾਂ ਅੱਜ ਕੱਲ੍ਹ ਦੇ ਹਿਸਾਬ ਨਾਲ ਬਹੁਤ ਹੀ ਅਲੱਗ ਅਲੱਗ ਡਿਜ਼ਾਇਨ ਦੇ ਸੂਟ ਤਿਆਰ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਹਿਸਾਬ ਨਾਲ ਹੀ ਅਸੀਂ ਸੂਟ ਦਾ ਨਾਪ ਲੈ ਸਕਦੇ ਹਾਂ